ਹਾਂ ਸਾਡੇ ਪੇਂਡੂ ਭਾਈਚਾਰੇ ਦੇ ਵਿੱਚ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਸ ਸਿਲਾਈ ਕਢਾਈ ਨੇ ਸਾਡੇ ਪਿੰਡ ਦੀਆਂ ਬਹੁਤ ਹੀ ਜਿਹੜੀਆਂ ਬੇਰੁਜ਼ਗਾਰ ਔਰਤਾਂ ਸੀ ਉਹਨਾਂ ਨੂੰ ਇੱਕ ਰੋਜ਼ਗਾਰ ਦਿੱਤਾ ਹੈ ਜਿਸ ਨਾਲ ਉਹ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਦੀਆਂ ਹਨ ਅਤੇ ਆਪਣੇ ਕੰਮ ਨਾਲ ਉਹ ਪੈਸਾ ਕਮਾ ਸਕਦੀਆਂ ਹਨ ਇਸ ਕਢਾਈ ਸਿਲਾਈ ਦੇ ਕੰਮ ਦੇ ਨਾਲ ਉਹ ਆਪਣਾ ਪੈਸਾ ਕਮਾ ਕੇ ਆਪਣਾ ਘਰ ਦਾ ਖਰਚ ਚਲਾ ਸਕਦੀਆਂ ਹਨ ਅਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਦੀਆਂ ਹਨ ਇੰਨਾ ਇਸ ਕਲਾ ਕਢਾਈ ਸਿਲਾਈ ਦੇ ਕੰਮ ਦੇ ਨਾਲ ਉਹਨਾਂ ਨੂੰ ਇੱਕ ਰੋਜ਼ਗਾਰ ਵੀ ਮਿਲਿਆ ਹੈ ਅਤੇ ਉਹਨਾਂ ਦੇ ਹੁਨਰ ਨੂੰ ਵੀ ਪਹਿਲ ਦਿੱਤੀ ਗਈ ਹੈ ਉਹਨਾਂ ਦੀ ਕਲਾ ਦੇ ਵਿੱਚ ਵਾਧਾ ਵੀ ਹੋਇਆ ਹੈ ਸਿਲਾਈ ਕਢਾਈ ਦੇ ਕੰਮ ਨੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਹੈ ਇਸ ਕੰਮ ਬਾਰੇ ਅਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਨਵਾਂ ਕੁਝ ਸਿੱਖਣ ਨੂੰ ਵੀ ਮਿਲਿਆ ਹੈ ਸਿਲਾਈ ਕਢਾਈ ਨੇ ਬਹੁਤ ਹੀ ਜ਼ਿਆਦਾ ਅਹਿਮੀਅਤ ਦਿੱਤੀ ਹੈ ਉਹਨਾਂ ਔਰਤਾਂ ਨੂੰ ਜੋ ਘਰੇ ਕੰਮ ਕਰਦੀਆਂ ਹਨ ਘਰੇਲੂ ਔਰਤਾਂ ਜੋ ਬਾਹਰ ਨਹੀਂ ਜਾ ਸਕਦੀਆਂ ਘਰ ਰਹਿ ਕੇ ਸਿਲਾਈ ਕਢਾਈ ਦਾ ਕੰਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਸਕਦੀਆਂ ਹਨ ਧੰਨ